ਹਾਂਜੀ ਮੈਂ ਲੋਕਾਂ ਨੂੰ ਦੇਖਣ ਲਈ ਆਪਣੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ ਮੈਂ ਵੈਸੇ ਤਾਂ ਬਹੁਤ ਸਾਰੇ ਐਪ ਯੂਸ ਕਰਦਾ ਹਾਂ ਅਤੇ ਮੈਂ ਆਪਣੀਆਂ ਤਸਵੀਰਾਂ ਪਾਉਂਦਾ ਰਹਿੰਦਾ ਹਾਂ ਪਰ ਮੈਂ ਜ਼ਿਆਦਾਤਰ ਫੇਸਬੁੱਕ ਇੰਸਟਾਗ੍ਰਾਮ 'ਤੇ ਆਪਣੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ ਮੈਂ ਤਸਵੀਰਾਂ ਦੇ ਨਾਲ ਨਾਲ ਵੀਡੀਓਸ ਵੀ ਪ੍ਰਦਰਸ਼ਿਤ ਕੀਤੀਆਂ ਹਨ ਅਤੇ ਜੇ ਇਸ ਤਰ੍ਹਾਂ ਕਰਨ ਨਾਲ ਮੇਰੇ ਤਜ਼ਰਬੇ ਦੀ ਗੱਲ ਕੀਤੀ ਜਾਵੇ ਤਾਂ ਮੇਰੀਆਂ ਫੋਟੋਆਂ ਅਤੇ ਵੀਡੀਓ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਅਤੇ ਬਹੁਤ ਵਧੀਆ ਕਮੈਂਟਸ ਕੀਤੇ ਹਨ ਇਸ ਨਾਲ ਮੈਂ ਹੋਰ ਵੀ ਫੋਟੋਆਂ ਪਾਉਣ ਲਈ ਚਾਹਵਾਨ ਹੋਇਆ ਹਾਂ